ਅ ਆਮ ਤੌਰ 'ਤੇ ਸਾਡੇ ਪਿੰਡਾਂ ਵਿੱਚ ਵਾਲ਼ਾਂ ਨੂੰ ਜਿਹੜੀ ਉਹਦੀ ਦੇਖਭਾਲ ਕਰਨ ਲਈ ਕੀ ਕੀਤਾ ਜਾਂਦਾ ਕਿ ਜਦੋਂ ਕਿਸੇ ਨੇ ਵੀ ਨਹਾਉਣਾ ਹੁੰਦਾ ਏ ਤਾਂ ਉਹ ਕੀ ਕਰਦੇ ਨੇ ਆਪਣੇ ਨਹਾਉਣ ਦੇ ਵੇਲੇ ਆਪਣਾ ਛੋਟੇ ਕਿਸੇ ਵੀ ਕਟੋਰੇ 'ਚ ਦਹੀਂ ਜਾਂ ਆਪਣਾ ਉਹ 'ਚ ਸਰ੍ਹੋਂ ਦਾ ਤੇਲ ਉਹਨੂੰ ਇਸਤੇਮਾਲ ਕਰਦੇ ਨੇ ਅਤੇ ਉਹਦੇ ਨਾਲ ਹੁੰਦਾ ਕੀ ਹੈ ਕਿ ਜਿਹੜੀ ਆਪਣੀ ਚਮੜੀ ਹੈ ਉਹ ਇੱਕ ਤਾਂ ਬਿਲਕੁਲ ਖੁਸ਼ਕ ਤੋਂ ਨਰਮ ਹੋ ਜਾਂਦੀ ਹੈ ਅਤੇ ਉਹਦੇ ਨਾਲ ਬਿਲਕੁਲ ਆਪਣੇ ਜਿਹੜੇ ਵਾਲ਼ ਹੈ ਉਹ ਇੱਕ ਤਾਂ ਮਜ਼ਬੂਤ ਰਹਿੰਦੇ ਨੇ ਅਤੇ ਟੁੱਟਦੇ ਘੱਟ ਨੇ ਅਤੇ ਆਮ ਤੌਰ 'ਤੇ ਕੀ ਹੁੰਦਾ ਜਿਹੜੇ ਆਪਣੇ ਪਿੰਡਾਂ 'ਚ ਸਰ੍ਹੋਂ ਦਾ ਤੇਲ ਅਤੇ ਨਾਰੀਅਲ ਤੇਲ ਬਹੁਤ ਹੀ ਮਸ਼ਹੂਰ ਹੁੰਦਾ ਏ ਅਤੇ ਉਹਦੀ ਮਾਲਿਸ਼ ਕਰਨ ਨਾਲ ਜਿੰਨੇ ਵੀ ਆਪਣੇ ਅੰਗ ਨੇ ਅਤੇ ਉਹ ਬਿਲਕੁਲ ਨਰਮ ਰਹਿੰਦੇ ਨੇ ਅਤੇ ਉਹਨਾਂ ਵਿੱਚ ਜਿਹੜਾ ਲਚਕੀਲਾਪਣ ਹੈ ਉਹ ਸਦਾ ਬਣਿਆ ਰਹਿੰਦਾ ਏ